ਜੇਕਰ ਅਸੀਂ ਧਰਮ ਦੀ ਗੱਲ ਕਰੀਏ ਤਾਂ ਧਰਮ ਕੋਈ ਵੀ ਧਰਮ ਹੈ ਚਾਹੇ ਉਹ ਧਰਮ ਸਭ ਨੂੰ ਜੋੜਦਾ ਹੈ ਧਰਮ ਤੋੜਦਾ ਨਹੀਂ ਹੈ ਧਰਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਕਿ ਅਸੀਂ ਸਿੱਖ ਧਰਮ ਦੇ ਹਾਂ ਤਾਂ ਸਿੱਖ ਧਰਮ ਦੇ ਵਿੱਚ ਕੋਈ ਵੀ ਦਿਹਾੜਾ ਆਉਂਦਾ ਕਿਸੀ ਗੁਰੂ ਸਾਹਿਬਾਨ ਦਾ ਸ਼ਹੀਦੀ ਦਿਨ ਆਉਂਦਾ ਹੈ ਜਾਂ ਪ੍ਰਕਾਸ਼ ਦਿਹਾੜਾ ਹੁੰਦਾ ਹੈ ਤਾਂ ਉਹਨਾਂ ਦੇ ਮੌਕੇ ਅ ਉਸ ਮੌਕੇ 'ਤੇ ਗੁਰਦੁਆਰਾ ਸਾਹਿਬਾਨਾਂ ਅ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਂਦੇ ਹਨ ਤਾਂ ਜਿਹੜੇ ਨਗਰ ਦੇ ਗੁਰਦੁਆਰਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਕੱਤਰਿਤ ਹੁੰਦੀਆਂ ਹਨ ਲੋਕ ਸੇਵਾ ਭਾਵਨਾ ਨਾਲ ਜਾਂਦੇ ਹਨ ਲੋਕ ਇਕੱਠੇ ਰਲ ਕੇ ਸੇਵਾ ਕਰਦੇ ਹਨ ਲੋਕ ਸੇਵਾ ਭਾਵਨਾ ਦੇ ਵਿੱਚ ਲੰਗਰਾਂ ਦੇ ਵਿੱਚ ਹਿੱਸੇ ਪਾਉਂਦੇ ਹਨ ਹੱਥੀਂ ਸੇਵਾ ਕਰਦੇ ਹਨ ਜਿਸ ਤਰ੍ਹਾਂ ਕਿ ਹਮਾ ਸਾਡੇ ਗੁਰਦੁਆਰੇ ਦੇ ਵਿੱਚ ਪਿੱਛੇ ਜਿਹੇ ਵਿਸਾਖੀ ਦਾ ਦਿਹਾੜਾ ਸੀ ਵਿਸਾਖੀ ਦੇ ਦਿਹਾੜੇ 'ਤੇ ਸਭ ਨੇ ਆ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਇਆ ਔਰ ਸਾਰੀਆਂ ਸਿੱਖ ਸੰਗਤਾਂ ਉੱਥੇ ਇਕੱਤਰਿਤ ਹੋਈਆਂ ਸਾਰੇ ਨੌਜਵਾਨਾਂ ਨੇ ਬੱਚਿਆਂ ਨੇ ਬੁੱਢਿਆਂ ਨੇ ਸਭ ਨੇ ਇੱਕ ਸੇਵਾ ਦੇ ਵਜੋਂ ਉੱਥੇ ਸੇਵਾ ਨਿਭਾਈ ਲੰਗਰਾਂ ਦੇ ਵਿੱਚ ਯੋਗਦਾਨ ਪਾਇਆ ਸੋ ਇਸ ਤਰ੍ਹਾਂ ਕਿ ਇੱਕ ਬਹੁਤ ਵਧੀਆ ਮੌਕਾ ਸਾਨੂੰ ਦੇਖਣ ਨੂੰ ਮਿਲਿਆ ਕਿ ਸਿੱਖ ਧ ਧਰਮ ਆ ਜਿਹੜਾ ਇੱਕ ਭਾਈਚਾਰੇ ਨੂੰ ਅ ਇਸ ਤਰ੍ਹਾਂ ਇਕੱਠਾ ਕਰਦਾ ਹੈ ਜਿੱਥੇ ਕੋਈ ਜਾਤ ਪਾਤ ਊਚ ਨੀਚ ਦਾ ਫ਼ਰਕ ਨਹੀਂ ਕੀਤਾ ਜਾਂਦਾ